ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਮਨੀ ਕੌਰ ਹੈ ਅਤੇ ਮੈਂ ਤਰਨ ਤਾਰਨ ਦੀ ਵਸਨੀਕ ਹਾਂ ਮੈਂ ਕੁਝ ਦਿਨ ਪਹਿਲਾਂ ਐਮਾਜ਼ੋਨ ਤੋਂ ਇੱਕ ਔਡਰ ਕੀਤਾ ਸੀ ਐਮਾਜ਼ੋਨ ਦੀ ਫਾਈਵ ਸਟਾਰ ਰੇਟਿੰਗ ਨੇ ਮੈਨੂੰ ਇੰਨਾ ਇੰਮਪ੍ਰੈਸ ਕਰ ਦਿੱਤਾ ਕਿ ਮੈਂ ਉਹ ਤੋਂ ਜਲਦੀ ਹੀ ਔਡਰ ਕਰ ਦਿੱਤਾ ਪਰ ਮੈਨੂੰ ਉਮੀਦ ਨਹੀਂ ਸੀ ਕੀ ਇਹ ਵਾਲਾ ਐਕਸਪੀਰੀਅੰਸ ਮੇਰਾ ਬਹੁਤ ਹੀ ਬੇਕਾਰ ਹੋਵੇਗਾ ਮੈਂ ਐਮਾਜ਼ੋਨ ਤੋਂ ਆਪਣੇ ਲਈ ਹੈੱਡਫੋਨਸ ਔਡਰ ਕੀਤੇ ਘਰ ਦੀ ਡਿਸਟਰਬੈਂਸ ਦੇ ਵਿੱਚ ਪੜ੍ਹਾਈ ਕਰਨੀ ਬਹੁਤ ਹੀ ਮੁਸ਼ਕਿਲ ਹੋ ਰਹੀ ਸੀ ਤਾਂ ਇਸ ਲਈ ਮੈਂ ਹੈੱਡਫੋਨਸ ਔਡਰ ਕਰ ਦਿੱਤੇ ਪਰ ਜਦ ਮੈਂ ਦਾ ਔਡਰ ਰਿਸੀਵ ਕੀਤਾ ਤਾਂ ਮੈਨੂੰ ਇੰਨਾ ਨਹੀਂ ਸੀ ਲੱਗਿਆ ਕਿ ਇਹ ਔਡਰ ਬਹੁਤ ਹੀ ਘਟੀਆ ਨਿਕਲੇਗਾ ਜਦੋਂ ਮੈਂ ਔਡਰ ਦੇਖਿਆ ਤਾਂ ਉਸ ਵਿੱਚ ਹੈੱਡਫੋਨ ਦੀ ਪੈਕਿੰਗ ਤਾਂ ਬਹੁਤ ਵਧੀਆ ਸੀ ਪਰ ਹੈੱਡਫੋਨਸ ਟੁੱਟੇ ਨਿਕਲੇ ਮੈਨੂੰ ਇਸ ਦਾ ਬਹੁਤ ਅਫ਼ਸੋਸ ਹੋਇਆ ਕਿਉਂਕਿ ਮੈਂ ਆਪਣੀ ਕੁਝ ਮਹੀਨਿਆਂ ਦੀ ਪੋਕਿਟ ਮਨੀ ਜੋੜ ਕੇ ਇਹ ਔਡਰ ਕੀਤਾ ਸੀ ਮੈਨੂੰ ਘਰਦਿਆਂ ਨੇ ਵੀ ਬਹੁਤ ਗੁੱਸੇ ਹੋਏ ਮੈਨੂੰ ਬਹੁਤ ਹੀ ਅਫ਼ਸੋਸ ਹੈ ਤੇ ਉਸ ਤੋਂ ਬਾਅਦ ਮੈਂ ਐਮਾਜ਼ੋਨ ਤੋਂ ਔਡਰ ਕਰਨਾ ਛੱਡ ਦਿੱਤਾ ਅਤੇ ਹੁਣ ਮੈਨੂੰ ਨਹੀਂ ਲੱਗਦਾ ਕਿ ਮੈਂ ਔਡਰ ਕਰਨਾ ਚਾਹੂੰਗੀ